ਅ ਮੈਂ ਇੱਕ ਵਰਕਿੰਗ ਲੇਡੀ ਹਾਂ ਅਤੇ ਮੈਂ ਸਕੂਲ ਵਿੱਚ ਜਿਹੜਾ ਪੜ੍ਹਾਉਂਦੀ ਹਾਂ ਉਹ ਸੀ ਬੀ ਐੱਸ ਈ ਬੋਰਡ ਹੈ ਅਤੇ ਬਹੁਤ ਦੇਰ ਤੋਂ ਮੇਰਾ ਡਰੀਮ ਸੀਗਾ ਕਿ ਮੈਂ ਆਈ ਸੀ ਐੱਸ ਈ ਬੋਰਡ ਵਿੱਚ ਟੀਚ ਕਰਾਂ ਅਤੇ ਉਹ ਮੌਕਾ ਮੈਨੂੰ ਮਿਲ ਵੀ ਗਿਆ ਕਿ ਮੇਰੀ ਜਿਹੜੀ ਸਿਲੈਕਸ਼ਨ ਸੀਗੀ ਉਹ ਆਈ ਸੀ ਐੱਸ ਈ ਬੋਰਡ ਵਿੱਚ ਹੋ ਗਈ ਠੀਕ ਹੈ ਏਜ਼ ਆ ਟੀਚਰ ਪਰ ਜਦੋਂ ਮੈਂ ਰੀਲੀਵ ਹੋਣ ਲੱਗੀ ਬੀ ਐੱਸ ਈ ਤੋਂ ਤਾਂ ਉਹ ਸਕੂਲ ਨੇ ਮੈਨੂੰ ਮਨ੍ਹਾ ਕਰਤਾ ਕਿ ਮੈਮ ਅਸੀਂ ਤੁਹਾਨੂੰ ਨਹੀਂ ਤੁਹਾਨੂੰ ਆਪਣੇ ਸਕੂਲ ਤੋਂ ਭੇਜਣਾ ਅਤੇ ਉਹ ਟਾਈਮ ਮੇਰੇ ਲਈ ਬਹੁਤ ਜ਼ਿਆਦਾ ਸੀਗਾ ਮੈਨੂੰ ਜਿਹੜਾ ਫੈਸਲਾ ਸੀ ਇੱਕ ਮੇਰੀ ਲਾਈਫ ਦਾ ਬੜਾ ਮਹੱਤਵਪੂਰਨ ਫੈਸਲਾ ਸੀ ਕੇ ਇੱਕ ਪਾਸੇ ਤਾਂ ਮਤਲਬ ਮੈਂ ਲਾਈਫ ਵਿੱਚ ਅੱਗੇ ਹੋ ਰਹੀ ਸੀਗੀ ਸਕਸੈਸ ਹੋ ਰਹੀ ਸੀਗੀ ਵਧੀਆ ਅਚੀਵਮੈਂਟ ਲੈ ਰਹੀ ਸੀ ਪਰ ਦੂਜੀ ਸਾਈਡ ਕੀ ਸੀਗਾ ਕਿ ਜਿਹੜੇ ਜਿੱਥੋਂ ਨਾਲ ਮੇਰਾ ਇੰਨਾ ਅਟੈਚਮੈਂਟ ਸੀ ਇੰਨਾ ਪਿਆਰ ਸੀ ਠੀਕ ਆ ਫਿਰ ਮੈਨੂੰ ਕੀ ਆ ਕਿ ਮੈਂ ਸੋਚਿਆ ਕਿ ਮੈਂ ਕਿਸੇ ਦੀ ਸਲਾਹ ਲਵਾਂ ਹੈ ਨਾ ਫੇਰ ਮੈਂ ਇਹਦੇ ਵਿੱਚ ਆਪਣੇ ਪੈਰੇਂਟਸ ਨੂੰ ਇਨਵੋਲਵ ਕੀਤਾ ਅਤੇ ਆਪਣੇ ਹਸਬੈਂਡ ਨੂੰ ਇਨਵੋਲਵ ਕੀਤਾ ਅਤੇ ਉਹਨਾਂ ਨੂੰ ਆਪਣੇ ਦਿਲ ਦਾ ਦੱਸਿਆ ਕਿ ਮਤਲਬ ਜਿਹੜਾ ਪੁਰਾਣਾ ਮੇਰਾ ਪਰੀਵੀਅਸ ਹੈ ਉੱਥੇ ਦਾ ਮੇਰਾ ਕੀ ਐਕਪੀਰੀਅਨਸ ਹੈ ਅਤੇ ਜਿਹੜੀ ਨਵੀਂ ਜਗ੍ਹਾ ਹੈ ਉਹਦੇ ਲਈ ਮੇਰੇ ਦਿਲ ਵਿੱਚ ਕੀ ਈਮਪੋਰਟੈਂਸ ਹੈ ਠੀਕ ਹੈ ਅਤੇ ਫਿਰ ਮੇਰੇ ਜਿਹੜੇ ਹਸਬੈਂਡ ਆ ਔਰ ਮੇਰੇ ਫੈਮਿਲੀ ਮੈਂਬਰਸ ਆ ਉਹਨਾਂ ਨੇ ਫਿਰ ਮੈਨੂੰ ਸਲਾਹ ਦਿੱਤੀ ਅਤੇ ਉਹਦੇ ਅਕੋਰਡਿੰਗ ਹੀ ਫਿਰ ਮੈਂ ਡਸੀਜ਼ਨ ਹੈ ਜਿਹੜਾ ਉਹ ਬਣਾਇਆ